ਔਨਲਾਈਨ ਸਕੂਲਿੰਗ ਨੇ ਅਤੇ ਕੋਚਿੰਗ ਨੇ ਬੱਚਿਆਂ ਦੇ ਜੀਵਨ ਨੂੰ ਬਹੁਤ ਪ੍ਰਭਾਵਿਤ ਕੀਤਾ ਕਿਉਂਕਿ ਇਸ ਦੇ ਨਾਲ ਬੱਚਿਆਂ ਦਾ ਬਹੁਤ ਨੁਕਸਾਨ ਹੁੰਦਾ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਬੱਚੇ ਨੇ ਉਹ ਫੋਨ ਦੇਖਦੇ ਨੇ ਫੋਨ ਦੇ ਨਾਲ ਉਨ੍ਹਾਂ ਦੀਆਂ ਅੱਖਾਂ 'ਤੇ ਬੁਰਾ ਅਸਰ ਪੈਂਦਾ ਅਤੇ ਉਸਤੋਂ ਬਾਅਦ ਦੂਸਰੀ ਗੱਲ ਕ ਕੁਛ ਜਿਹੜੇ ਮਾਂ ਬਾਪ ਹੁੰਦੇ ਨੇ ਉਹ ਅਨਪੜ੍ਹ ਹੁੰਦੇ ਨੇ ਉਨ੍ਹਾਂ ਨੂੰ ਨਹੀਂ ਪਤਾ ਹੁੰਦਾ ਨਿਊ ਟਕਨੋਲਜ਼ੀ ਬਾਰੇ ਪਰ ਜਿਹੜੇ ਬੱਚਿਆਂ ਨੂੰ ਅੱਜ ਦੀ ਨਿਊ ਟਕਨੋਲਜੀ ਬਾਰੇ ਬਹੁਤ ਪਤਾ ਕਿਉਂਕਿ ਕਈ ਵਾਰ ਬੱਚੇ ਇੱਦਾਂ ਹੁੰਦੇ ਨੇ ਬਹਾਨਾ ਲਗਾ ਕੇ ਝੂਠ ਬੋਲ ਕੇ ਮਾਂ ਬਾਪ ਤੋਂ ਫੋਨ ਲੈ ਲੈਂਦੇ ਨੇ ਅਤੇ ਉਹਦੇ ਨਾਲ ਕੀ ਹੈਗਾ ਵੀ ਬੱ ਬ ਪੇਰੈਂਟਸ ਨੂੰ ਇਹ ਅਹਿਸਾਸ ਹੁੰਦਾ ਵੀ ਸਾਡੇ ਬੱਚੇ ਪੜ੍ਹਾਈ ਕਰ ਰਹੇ ਨੇ ਪਰ ਫੋਨ ਦੇ ਵਿੱਚ ਪੋਜਟਿਵਿਟੀ ਵੀ ਬਹੁਤ ਹੁੰਦੀ ਹੈ ਫ਼ਾਇਦੇ ਵੀ ਬਹੁਤ ਨੇ ਪਰ ਇਹਦੇ ਨਾਲ ਕੀ ਹੈ ਨੁਕਸਾਨ ਵੀ ਬਹੁਤ ਹੁੰਦੇ ਨੇ ਬੱਚਿਆਂ ਦੀਆਂ ਅੱਖਾਂ 'ਤੇ ਅਸਰ ਪੈਂਦਾ ਬੱਚਿਆਂ ਨੂੰ ਗੇਮਜ਼ ਵਗੈਰਾ ਖੇਡ ਦੇ ਨੇ ਫੋ ਸਟੱਡੀ ਵੱਲ ਧਿਆਨ ਘੱਟ ਦਿੰਦੇ ਨੇ ਫੋਨ ਵੱਲ ਜ਼ਿਆਦਾ ਦਿੰਦੇ ਨੇ ਤਾਂ ਕਰਕੇ ਜਿਹੜੇ ਬੱਚੇ ਨੇ ਬੱਚਿਆਂ ਜਿਹੜੇ ਔਨਲਾਈਨ ਸਕੂਲਿੰਗ ਨੇ ਬੱਚਿਆਂ ਦੀ ਸਟੱਡੀ ਨੂੰ ਬੱਚਿਆਂ ਦੇ ਜ਼ਿੰਦਗੀ ਨੂੰ ਬਹੁਤ ਪ੍ਰਭਾਵਿਤ ਕੀਤਾ ਬੱਚੇ ਲਿਖਣਾ ਇਹਦੇ ਨਾਲ ਕੀ ਹੈ ਇੱਕ ਤਾਂ ਬੱਚਿਆਂ ਦੀ ਰਾਈਟਿੰਗ ਨਹੀਂ ਠੀਕ ਹੁੰਦੀ ਬੱਚੇ ਲਿਖਦੇ ਨਹੀਂ ਸੁਣਦੇ ਰਹਿੰਦੇ ਨੇ ਦੇਖਦੇ ਰਹਿੰਦੇ ਨੇ ਫੋਨ ਵੱਲ ਦੇਖਣ ਨਾਲ ਵੀ ਬੱਚਿਆਂ ਦਾ ਅੱਖਾਂ ਦਾ ਅਸਰ ਪੈਂਦਾ ਬੱਚਿਆਂ ਦੇ ਮਾਈਂਡ ਡਾਈਵਰਟ ਹੋ ਜਾਂਦਾ ਹੈ ਪੜ੍ਹਾਈ ਦਾ ਛੱਡ ਕੇ ਉਹ ਦੂਸਰੀਆਂ ਚੀਜ਼ਾਂ ਵੱਲ ਵੱਧ ਧਿਆਨ ਦਿੰਦੇ ਨੇ ਅਤੇ ਕੋਚਿੰਗ ਜਿਹੜੀ ਔਨਲਾਈਨ ਸਕੂਲਿੰਗ ਅਤੇ ਕੋਚਿੰਗ ਨੇ ਵੀ ਬੱਚਿਆਂ ਨੂੰ ਬਹੁਤ ਜ਼ਿਆਦਾ ਗਲਤ ਰਸਤਿਆਂ 'ਤੇ ਪਾਇਆ ਬੱਚੇ ਫੋਨ ਦਾ ਗਲਤ ਯੂਜ ਕਰਦੇ ਨੇ ਗਲਤ ਚੀਜ਼ਾਂ ਸਿੱਖਦੇ ਨੇ ਇਸਦੇ ਨੇ ਨਾਲ ਕੀ ਹੈ ਕਿ ਬੱਚਿਆਂ ਨੂੰ ਔਨਲਾਈਨ ਸਟੱਡੀ ਦੇ ਨਾਲੋਂ ਆਫਲਾਈਨ ਸਟੱਡੀ ਹੁੰਦੀ ਹੈ ਜਿਹੜੀ ਉਹ ਬੈਟਰ ਰਹਿੰਦੀ ਹੈ